ਵਧੀਆ ਵਧੀਆ ਹਾਂਜੀ ਕੀ ਹਾਲ ਹੈ

ਅੱਛਾ ਅੱਛਾ ਤੇ ਬਸ ਬਸ ਵਧੀਆ ਠੀਕ ਠਾਕ ਹੈ ਹਾਂ ਆ ਜਾਓ ਬਠਿੰਡੇ ਅੱਛਾ ਆਪਣੇ ਸੁਖ਼ਨਾ ਲੇਕ ਹੈਗੀ ਆ ਬਠਿੰਡੇ ਅਤੇ ਗੁਰਦੁਆਰਾ ਇਤਿਹਾਸਿਕ ਆਪਣਾ ਗੁਰਦੁਆਰਾ ਸਾਹਿਬ ਹੈ ਦਮਦਮਾ ਸਾਹਿਬ ਹੈ ਤਲਵੰਡੀ ਸਾਬੋ ਅਤੇ ਆਪਾਂ ਕਿਲ੍ਹਾ ਮੁ ਕਿਲ੍ਹਾ ਮੁਬਾਰਕ ਹੈ ਅਤੇ ਮਿਤ ਮਿੱਤਲ ਮੌਲਾ ਹੈ ਝੀ ਝੀਲਾਂ ਦੇ ਝੀਲਾਂ 'ਤੇ ਚੱਲਾਂਗੇ ਉੱਤੋਂ ਉੱਥੇ ਘੁੰਮਦੇ ਫਿਰਦੇ ਸ਼ਾਮ ਨੂੰ ਫਿਰ ਵਧੀਆ ਘੁੰਮਣ ਦਾ ਨਜ਼ਾਰਾ ਆ ਜਾਂਦਾ ਉੱਥੇ ਕਿਸ਼ਤੀਆਂ ਕੁਸ਼ਤੀਆਂ ਛੱਡੀਆਂ ਹੋਈਆਂ ਐਣ ਉੱਥੇ ਹਾਂ ਹਾਂ ਹਾਂ ਅਤੇ ਉਦੋਂ ਬਾਅਦ ਆਪਾਂ ਆ ਜਾਵਾਂਗੇ ਇੱਧਰ ਕਿਲ ਕਿਲ੍ਹਾ ਮੁਬਾਰਕ ਆ ਜਾਵਾਂਗੇ ਉੱਥੇ ਉੱਥੇ ਬਠਿੰਡੇ ਉੱਥੇ ਬਠਿੰਡੇ ਦੇ ਇਤਿਹਾਸ ਬਾਰੇ ਦੱਸਿਆ ਗਿਆ ਸਾਰਾ ਕੁਛ ਅਤੇ ਇੱਕ ਬਠਿੰਡਾ ਵਸਾਇਆ ਕਿਹਨਾਂ ਨੇ ਸੀਗਾ ਤੇ ਕੌਣ ਹਾਂ ਹਾਂ ਅੱਗੇ ਤਾਂ ਬਹੁਤ ਫਰਕ ਪਿਆ ਅੱਗੇ ਨਾਲ ਬਹੁਤ ਚੀਜ਼ਾਂ ਨਵੀਆਂ ਆ ਗਈਆਂ ਬਾਕੀ ਸਰਕਾਰਾਂ ਅੱਗੇ ਅੱਗੇ ਵਧਾ ਰਹੀਆਂ ਬਠਿੰਡੇ ਨੂੰ ਹਾਂ ਹਾਂ ਤੇ ਅੱਗਿਓਂ ਆਪਾਂ ਤਲਵੰਡੀ ਸਾਬੋ ਚੱਲ ਫਿਰਾਂਗੇ ਮਨਪ੍ਰੀਤ ਕੋਲ ਕਰ ਦਿਓ ਕੋਈ ਨਹੀਂ ਤੁਹਾਡੇ ਲਈ ਆਪਾਂ ਫਰੀ ਫਰੀ ਆਂ ਹਾਂ ਹਾਂ ਕੋਈ ਗੱਲ ਨਹੀਂ ਸ਼ਨੀ ਐਤਵਾਰ ਆ ਜਾਇਓ ਹਾਂ ਮੋਰਨਿੰਗ ਆ ਜਾਓ ਆਪਾਂ ਚਾਹ ਪੋ ਤੇ ਤੇ ਚਾਹ ਕਰਾਂਗੇ ਸਾਰਾ ਹਾਂ ਜਿੰਨੀਆਂ ਵੀ ਹੈਗੀਆਂ ਹਾਂ ਠੀਕ ਹੈ ਠੀਕ ਹੈ ਜੀ ਓਕੇ